ਭੰਗੜਾ ਸਾਡੇ ਪੰਜਾਬ ਦੀਆਂ ਬਹੁਤ ਹੀ ਅਹਿਮ ਭੂਮਿਕਾ ਹੈ ਜੋ ਕਿ ਇਹ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਅਸੀਂ ਹਰੇਕ ਵਿਆਹ ਫੰਕਸ਼ਨ ਜਾਂ ਇ ਸਕੂਲਾਂ ਕਾਲਜਾਂ ਵਿੱਚ ਵੀ ਬੱਚਿਆਂ ਨੂੰ ਭੰਗੜਾ ਸਿਖਾਇਆ ਜਾਂਦਾ ਹੈ ਕਿਉਂਕਿ ਇਹ ਹੀ ਪੰਜਾਬ ਦੀ ਸੰਸਕ੍ਰਿਤੀ ਹੈ ਜੇਕਰ ਅਸੀਂ ਗੱਲ ਕਰੀਏ ਭੰਗੜੇ ਦੇ ਐਰੋਬਿਕਸ ਭਵਿੱਖ ਵਿੱਚ ਜਾਣ ਦੀ ਤਾਂ ਭੰਗੜਾ ਸਾਡੇ ਸਰੀਰ ਵਾਸਤੇ ਵੀ ਬਹੁਤ ਹੀ ਚੰਗਾ ਹੁੰਦਾ ਹੈ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਇਸ ਨਾਲ ਸਾਡੇ ਸਰੀਰ ਵਿੱਚ ਲਚਕਤਾ ਪੈਦਾ ਹੁੰਦੀ ਹੈ ਅਸੀਂ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਸਾਡਾ ਸਰੀਰ ਇਸ ਨਾਲ ਬਹੁਤ ਤੰਦਰੁਸਤ ਰਹਿੰਦਾ ਹੈ ਅਤੇ ਅੱਜ ਕੱਲ੍ਹ ਜਿਮ ਵਿੱਚ ਵੀ ਲੋਕਾਂ ਨੂੰ ਭੰਗੜੇ ਦੇ ਤੌਰ 'ਤੇ ਐਕਸਰਸਾਈਜ਼ ਕਰਵਾਈ ਜਾਂਦੀ ਹੈ ਕਿਉਂਕਿ ਇਹ ਸਾਨੂੰ ਮੋਟਾਪੇ ਤੋਂ ਵੀ ਬਚਾ ਰੱਖਦਾ ਹੈ ਅਤੇ ਇਹ ਕਾਫ਼ੀ ਫੈਟ ਸਾਡੀ ਜਲਾਉਂਦਾ ਹੈ ਭੰਗੜਾ ਅੱਜ ਕੱਲ੍ਹ ਫਿਲਮਾਂ ਵਿੱਚ ਵੀ ਬਹੁਤ ਹੀ ਪ੍ਰਸਿੱਧ ਹੈ ਅਤੇ ਇਸ ਦਾ ਭਵਿੱਖ ਐਰੋਬਿਕਸ ਵਿੱਚ ਬਹੁਤ ਹੀ ਉੱਚਾ ਹੋਵੇਗਾ ਕਿਉਂਕਿ ਅੱਜ ਕੱਲ੍ਹ ਹਰੇਕ ਐਕਟਰ ਹਰੇਕ ਪ੍ਰਸਿੱਧ ਵਿਅਕਤੀ ਇਸ ਦਾ ਇਸਤੇਮਾਲ ਕਰਕੇ ਇੰਟਰਨੈਟ 'ਤੇ ਵੀ ਛਾ ਰਿਹਾ ਹੈ ਉਹ ਵੀ ਲੋਕਾਂ ਨੂੰ ਦੱਸ ਰਿਹਾ ਹੈ ਕਿ ਭੰਗੜੇ ਦੀ ਮਦਦ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਉਹ 'ਚ ਲਚਕਦਾ ਪੈਦਾ ਕਰ ਸਕਦੇ ਹਾਂ